ਇੱਕ ਜਨਵਰੀ ਦੋ ਹਜ਼ਾਰ ਤਿੰਨ ਛੇ ਅਕਤੂਬਰ ਦੋ ਹਜ਼ਾਰ ਚਾਰ ਪੰਜ ਜਨਵਰੀ ਦੋ ਹਜ਼ਾਰ ਅੱਠ ਨੌ ਦਸੰਬਰ ਦੋ ਹਜ਼ਾਰ ਅੱਠ ਚਾਰ ਦਸੰਬਰ ਦੋ ਹਜ਼ਾਰ ਬਾਰ੍ਹਾਂ